ਨੈਗੇਟਿਵ ਐਕਸਪੀਰੀਐਂਸ ਤਾਂ ਮੈਨੂੰ ਬਹੁਤ ਵੱਡਾ ਹੋਇਆ ਪਿਛਲੇ ਕੁਛ ਟਾਈਮ ਪਹਿਲਾਂ ਦੀ ਗੱਲ ਹੈ ਮੈਂ ਮਿੰਤਰਾ ਤੋਂ ਇੱਕ ਕੁੜਤੀ ਮੰਗਵਾਈ ਕਹਿਣ ਦਿੱਤਾ ਕਿ ਕੋਟਨ ਦੀ ਕੁੜਤੀ ਹੈ ਨਾ ਉਹਨਾਂ ਦਾ ਕਲਰ ਉਹੋ ਜਿਹਾ ਨਾ ਉਹਨਾਂ ਦਾ ਡਿਜ਼ਾਇਨ ਉਹੋ ਜਿਹਾ ਉੱਤੋਂ ਫੈਬਰਿਕ ਵੀ ਵੱਖਰਾ ਭੇਜ ਦਿੱਤਾ ਕਹਿ ਲਓ ਕਿ ਜੋ ਔਡਰ ਕੀਤਾ ਹੈ ਨਾ ਉਸ ਤੋਂ ਬਿਲਕੁਲ ਉਲਟਾ ਹੀ ਮਿਲ ਗਿਆ ਇੱਥੋਂ ਤੱਕ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਸਾਈਜ਼ ਹੀ ਅਸੀਂ ਸਹੀ ਭੇਜ ਦੇਈਏ ਜਿਹੜਾ ਮੈਂ ਸਾਈਜ਼ ਮੰਗਾਇਆ ਉਸ ਤੋਂ ਕਹਿ ਲਓ ਕਿ ਦੋ ਜਗ੍ਹਾ ਛੋਟਾ ਸਾਈਜ਼ ਆ ਗਿਆ ਮੇਰਾ ਇੰਨਾ ਮਾੜਾ ਐਕਸਪੀਰੀਐਂਸ ਰਿਹਾ ਕੀ ਦੁਬਾਰਾ ਮੈਂ ਕਦੇ ਹਿੰਮਤ ਨਹੀਂ ਕੀਤੀ ਕਿ ਮੈਂ ਔਨਲਾਈਨ ਕੋਈ ਸ਼ੋਪਿੰਗ ਕਰਾਂ ਕੁਛ ਮੰਗਾਵਾਂ ਕਿਉਂਕਿ ਮੇਰਾ ਇੰਨਾ ਮਾੜਾ ਐਕਸਪੀਰੀਅੰਸ ਰਿਹਾ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਕਿਹਾ ਜੀ ਐਕਸਚੇਂਜ ਕਰ ਦਿਓ ਐਕਸਚੇਂਜ ਕਰਕੇ ਅਤੇ ਫਿਰ ਉਸ ਤੋਂ ਵੀ ਮਾੜਾ ਪ੍ਰੋਡਕਟ ਮੇਰੇ ਮੱਥੇ ਮੜ ਗਏ ਜਿਹੜਾ ਕਿ ਉਸ ਤੋਂ ਵੀ ਗਿਆ ਗਵਾਚਿਆ ਸੀ ਉਹ ਇੰਨਾ ਕੁ ਸਿੰਥੈਟਿਕ ਕਹਿ ਲਓ ਕਿ ਪੈ ਹੀ ਨਹੀਂ ਸਕਦਾ ਗਰਮੀਆਂ ਵਿੱਚ ਕੋਟਨ ਫੈਬਰਿਕ ਐ ਕੇ ਮੈਂ ਮੰਗਾਇਆ ਨਿਕਲਿਆ ਉਹ ਕੁਛ ਹੋਰ ਮੇਰੇ ਤਾਂ ਬਿਲਕੁਲ ਹੀ ਇੰਨਾ ਮਾੜਾ ਐਕਸਪੀਰੀਅਐਂਸ ਰਿਹਾ ਮੈਂ ਤਾਂ ਸਾਰਿਆਂ ਨੂੰ ਕਹਾਂਗੀ ਕਿ ਅੱਜ ਤੋਂ ਬਾਅਦ ਕਦੇ ਮੰਤਰਾ ਤੋਂ ਸ਼ੋਪਿੰਗ ਨਾ ਕਰੋ ਕਦੇ ਕੁਛ ਨਾ ਮੰਗਵਾਓ ਇੱਕ ਤਾਂ ਇਹ ਫਾਲਤੂ ਦੇ ਚਾਰਜਿਸ ਲਾ ਦਿੰਦੇ ਨੇ ਅਤੇ ਉੱਤੋਂ ਡਿਲੀਵਰੀ ਚਾਰਜਿਸ ਵੀ ਹੁਣ ਵਧਾ ਤੇ ਆ ਉੱਤੋਂ ਕੱਪੜਾ ਵੀ ਮਾੜਾ ਹੋ ਗਿਆ ਪਹਿਲਾਂ ਸੀ ਕਿ ਕੁੱਛ ਮੈਂ ਤਾਂ ਸੁਣ ਸੁਣ ਕੇ ਲੋਕਾਂ ਕੋਲੋਂ ਬੜਾ ਸੁਣਿਆ ਸੀ ਲੇਕਿਨ ਮੇਰਾ ਐਕਸਪੀਰੀਐਂਸ ਵਾਕਈ ਬੜਾ ਮਾੜਾ ਰਿਹਾ ਮੈਂ ਤਾਂ ਹਰ ਕਿਸੇ ਨੂੰ ਕਹਾਂਗੀ ਕਿ ਛੱਡ ਹੀ ਦਿਓ ਇਹਦੇ ਨਾਲੋਂ ਬਾਜ਼ਾਰ ਜਾ ਕੇ ਕਮ ਸੇ ਕਮ ਤੁਸੀਂ ਆਪਣੀ ਪਸੰਦ ਦੀ ਚੀਜ਼ ਤਾਂ ਲੈ ਆਉਂਦੇ ਹੋ ਇੱਥੇ ਤਾਂ ਪਤਾ ਨਹੀਂ ਕਿਹੜਾ ਚੀਜ਼ ਪੈਕ ਕਰਕੇ ਅਤੇ ਕਦੋਂ ਉਹਨਾਂ ਨੇ ਅਤੇ ਕਿਵੇਂ ਤੁਹਾਨੂੰ ਫੜਾ ਜਾਣੀ ਹੈ